ਪੰਜਾਬ ਵਿੱਚ ਦੁਰਘਟਨਾ ਮੁਆਵਜ਼ਾ ਅਤੇ ਸੱਟਾਂ ਨਾਲ ਸੰਬੰਧਿਤ ਕਈ ਕਾਨੂੰਨ ਅਤੇ ਪ੍ਰਸ਼ਾਸਕੀ ਕਿਰਿਆਵਾਂ ਹਨ ਜਦੋਂ ਕੋਈ ਵੀ ਵਿਅਕਤੀ ਦੁਰਘਟਨਾ ਦਾ ਸ਼ਿਕਾਰ ਹੁੰਦਾ ਹੈ ਜਾਂ ਉਸ ਨੂੰ ਸੱਟ ਲੱਗਦੀ ਹੈ ਤਾਂ ਉਹਨਾਂ ਨੂੰ ਮੁਆਵਜ਼ਾ ਪ੍ਰਾਪਤ ਕਰਨ ਲਈ ਕਈ ਕਦਮ ਚੁੱਕਣੇ ਪੈਂਦੇ ਹਨ ਠੀਕ ਹੈ ਕੁਛ ਦਾ ਵਿਸਤਾਰ ਇਸ ਪ੍ਰਕਾਰ ਹੈ ਪਹਿਲਾ ਹੈ ਦੁਰਘਟਨਾ ਮੁਆਵਜ਼ਾ ਦੁਰਘਟਨਾ ਮੁਆਵਜ਼ਾ ਇਕ ਐਸਾ ਮੁਆਵਜ਼ਾ ਹੈ ਜੋ ਕਿਸੇ ਵਿਅਕਤੀ ਨੂੰ ਦੁਰਘਟਨਾ ਦੇ ਕਾਰਨ ਹੋਈ ਸੱਟਾਂ ਜਾਂ ਹਾਨੀ ਲਈ ਮਿਲਦਾ ਹੈ ਇਹ ਮੁਆਵਜ਼ਾ ਅਦਾਲਤ ਦੁਆਰਾ ਜਾਂ ਬੀਮਾ ਕੰਪਨੀਆਂ ਦੁਆਰਾ ਦਿੱਤਾ ਜਾ ਸਕਦਾ ਹੈ ਪੰਜਾਬ ਵਿੱਚ ਦੁਰਘਟਨਾ ਦੇ ਪੀੜਤਾਂ ਨੂੰ ਮੁਆਵਜ਼ਾ ਪ੍ਰਾਪਤ ਕਰਨ ਲਈ ਦੂਰ ਦਰਘਟਨਾ ਮੁਆਵਜ਼ਾ ਕਿਮੀਸ਼ਨ ਜਾਂ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਵਿੱਚ ਮਾਮਲਾ ਦਰਜ ਕਰਨਾ ਪੈਂਦਾ ਹੈ ਫਿਰ ਹੀ ਉਹਨਾਂ ਨੂੰ ਮੁਆਵਜ਼ਾ ਮਿਲਦਾ ਹੈ ਦੂਜਾ ਹੈ ਬੀਮਾ ਬੀਮਾ ਸਹਾਇਤਾ ਪ੍ਰਦਾਨ ਕਰਨ ਵਾਲਾ ਇੱਕ ਅਹਿਮ ਸਾਧਨ ਹੈ ਜਦੋਂ ਦੁੱਖ ਦੁਰਘਟਨਾ ਅਤੇ ਸੱਟ ਲੱਗਦੀ ਹੈ ਤਾਂ ਬੀਮਾ ਪੋਲੀਸੀ ਦੇ ਅਧੀਨ ਮੁਆਵਜ਼ਾ ਮੰਗਿਆ ਜਾ ਸਕਦਾ ਹੈ ਜਨਰਲ ਡੈਮੇਜ ਵਾਹਨ ਬੀਮਾ ਮੋਟਰ ਵਾਹਨ ਐਕਟ ਆਦਿ ਵਿੱਚ ਇਹ ਪ੍ਰਬੰਧ ਹਨ ਕਿ ਕਿਸੇ ਵਾਹਨ ਦੇ ਸੰਬੰਧੀ ਦੁਰਘਟਨਾ ਹੋਣ 'ਤੇ ਬੀਮਾ ਕੰਪਨੀ ਮੁਆਵਜ਼ਾ ਦੇਵੇਗੀ ਬੀਮਾ ਕੰਪਨੀ ਨੇ ਇਹ ਯਕੀਨੀ ਬਣਾਉਣਾ ਹੈ ਕਿ ਦੁਰਘਟਨਾ ਦੇ ਕਾਰਨ ਹਾਲਤ ਵਿੱਚ ਆਈ ਹਾਨੀ ਦੀ ਪੂਰੀ ਭਰਪਾਈ ਕੀਤੀ ਜਾਵੇ ਜਾਵੇ ਅਤੇ ਉਹ ਬੰਦਾ ਜਿਸ ਨਾਲ ਇਹ ਘਟਨਾ ਵਾਪਰੀ ਹੈ ਉਸਨੂੰ ਵੀ ਜ਼ਿਆਦਾ ਨੁਕਸਾਨ ਨਾ ਹੋਵੇ ਤੀਜਾ ਹੈ ਨਿੱਜੀ ਸੱਟ ਮੁਆਵਜ਼ਾ ਨਿੱਜੀ ਸੱਟ ਮੁਆਵਜ਼ਾ ਉਹ ਮੁਆਵਜ਼ਾ ਹੈ ਜੋ ਕਿਸੇ ਵਿਅਕਤੀ ਨੂੰ ਉਸਦੀਆਂ ਸੱਟਾਂ ਦੇ ਕਾਰਨ ਦਿੱਤਾ ਜਾਂਦਾ ਹੈ ਇਸ ਵਿੱਚ ਸਰੀਰਕ ਮਾਨਸਿਕ ਅਤੇ ਆਰਥਿਕ ਹਾਨੀ ਸ਼ਾਮਿਲ ਹੋ ਸਕਦੀ ਹੈ ਇਸ ਪ੍ਰਕ੍ਰਿਆ ਵਿੱਚ ਪੀੜਿਤ ਨੂੰ ਆਪਣੀਆਂ ਸੱਟਾਂ ਦੀ ਸਟੇਟਮੈਂਟ ਅਤੇ ਮੈਡੀਕਲ ਰਿਪੋਰਟ ਦਿੱਤੀਆਂ ਜਾਂਦੀਆਂ ਹਨ ਜੋ ਅਦਾਲਤ ਜਾਂ ਟ੍ਰਿਬਿਊਨਲ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਰਿਪੋਰਟ ਦੇ ਆਧਾਰ 'ਤੇ ਹੀ ਉਸ ਬੰਦੇ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਅਤੇ ਇਹ ਦੇਖਿਆ ਜਾਂਦਾ ਹੈ ਕਿ ਉਸਦੀ ਡਿਸਬਿਲਟੀ ਕਿੰਨੇ ਪਰਸੈਂਟ ਹੈ ਫਿਰ ਹੀ ਉਸਨੂੰ ਮੁਆਵਜ਼ਾ

ਚੌਥਾ ਹੈ ਮੋਟਰ ਵਾਹਨ ਐਕਟ ਮੋਟਰ ਵਾਹਨ ਐਕਟ ਉੱਨੀ ਸੌ ਅਠਾਸੀ ਭਾਰਤ ਵਿੱਚ ਵਾਹਨਾਂ ਦੇ ਪ੍ਰਬੰਧ ਅਤੇ ਦੁਰਘਟਨਾਵਾਂ ਦੀ ਹਾਲਤ ਵਿੱਚ ਮੁਆਵਜ਼ੇ ਦੇ ਨਿਯਮਾਂ ਨੂੰ ਪਰਿਵ ਪਰਿਵਰਤਿਤ ਕਰਦਾ ਹੈ ਇਸ ਟੇਕਸਟ ਐਕਟ ਦੇ ਤਹਿਤ ਵਾਹਨ ਮਾਲਕਾਂ ਨੂੰ ਬੀਮਾਂ ਲੈਣਾ ਜ਼ਰੂਰੀ ਹੈ ਅਤੇ ਕਿਸੇ ਵੀ ਦੁਰਘਟਨਾ ਦੀ ਸਥਿਤੀ ਵਿੱਚ ਮੁਆਵਜ਼ਾ ਦਿੱਤਾ ਜਾਂਦਾ ਹੈ ਮੋਟਰ ਵਾਹਨ ਐਕਟ ਵਿੱਚ ਸਾਰੇ ਪਰੂਫ ਲਗਾਉਣੇ ਪੈਂਦੇ ਹਨ ਕਿ ਐਕਸੀਡੈਂਟ ਕਿਵੇਂ ਹੋਇਆ ਜੋ ਵੀ ਸਾਰੇ ਬੰਦੇ ਦੇ ਮੌਜੂਦਾ ਸਬੂਤ ਹੁੰਦੇ ਹਨ ਉਹ ਸਾਰੇ ਦੇਣੇ ਪੈਂਦੇ ਹਨ ਪੰਜਵਾਂ ਹੈ ਹਸਪਤਾਲ ਅਤੇ ਮੈਡੀਕਲ ਸਹਾਇਤਾ ਦੁਰਘਟਨਾ ਜਾਂ ਸੱਟ ਦੇ ਕਾਰਨ ਪੀੜਿਤ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੁੰਦੀ ਹੈ ਪੰਜਾਬ ਵਿੱਚ ਕਈ ਸਰਕਾਰੀ ਅਤੇ ਨਿੱਜੀ ਹਸਪਤਾਲ ਹਨ ਜੋ ਦੁਰਘਟਨਾ ਪੀੜਿਤਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਪ੍ਰਦਾਨ ਕਰਦੇ ਹਨ ਮੈਡੀਕਲ ਬਿਲ ਅਤੇ ਖਰਚੇ ਬੀਮਾ ਪੋਲਿਸੀ ਦੇ ਤਹਿਤ ਕਲੇਮ ਕੀਤੇ ਜਾ ਸਕਦੇ ਹਨ ਇਹ ਵਿਵਸਥਾਵਾਂ ਵੀ ਕਿਵੇਂ ਬਣਾਉਂਦੇ ਹਨ ਕਿ ਦੁਰਘਟਨਾ ਪੀੜਤਾਂ ਨੂੰ ਉਹਨਾਂ ਦੀ ਹਾਨੀ ਦੀ ਪੂਰੀ ਤਰ੍ਹਾਂ ਭਰਪਾਈ ਮਿਲੇ